ਪਿਛਲੇ ਦਿਨੀ ਮੈਂ ਆਪਣੇ ਇੱਕ ਦੋਸਤ ਦੇ ਨਾਲ ਦੇਹਰਾਦੂਨ ਘੁੰਮਣ ਗਿਆ ਅਤੇ ਉੱਥੋਂ ਅਸੀਂ ਮਸੂਰੀ ਘੁੰਮਣ ਗਏ ਜੋ ਇੱਕ ਬਹੁਤ ਹੀ ਸੁੰਦਰ ਥਾਂ ਹੈ ਮਸੂਰੀ ਦੇ ਵਿਖੇ ਇੱਕ ਮਾਲ ਰੋਡ ਬਹੁਤ ਹੀ ਸੈਲਾਨੀਆਂ ਦੀ ਖਿੱਚ ਦਾ ਥਾਂ ਹੈ ਅਸੀਂ ਉੱਥੇ ਵੀ ਘੁੰਮੇ ਉੱਥੇ ਉੱਥੋਂ ਤੋਂ ਮਸੂਰੀ ਤੋਂ ਦੇਹਰਾਦੂਨ ਦਾ ਬਹੁਤ ਸੁੰਦਰ ਨਜ਼ਾਰਾ ਦਿਖਦਾ ਹੈ ਇਸ ਤੋਂ ਅੱਗੇ ਅਸੀਂ ਇੱਕ ਪਾਰਕ ਦੇ ਵਿੱਚ ਗਏ ਬਹੁਤ ਹੀ ਉਹ ਵੀ ਪਾਰਕ ਸੁੰਦਰ ਬਣਿਆ ਹੋਇਆ ਹੈ ਜਿਸ ਦੇ ਵਿੱਚ ਬਹੁਤ ਸਾਰੇ ਸੈਲਾਨੀ ਆਉਂਦੇ ਹਨ ਅਤੇ ਉੱਥੇ ਭਾਂਤ ਭਾਂਤ ਦੇ ਫੁੱਲ ਦੇਖਣ ਨੂੰ ਮਿਲਦੇ ਹਨ ਇਸ ਦੇ ਨੇੜੇ ਹੀ ਇੱਕ ਕੈਂਪਟੀ ਫਾਲ ਨਾਂ ਦੀ ਜਗ੍ਹਾ ਹੈ ਜੋ ਕਿ ਇੱਕ ਬਹੁਤ ਵਧੀਆ ਚਸ਼ਮਾ ਹੈ ਉਸ ਚਸ਼ਮੇ ਦੇ ਉੱਪਰ ਵੀ ਸੈਲਾਨੀ ਜੋ ਹਨ ਕਈ ਨਹਾਉਂਦੇ ਹਨ ਔਰ ਕਈ ਉਸ ਦੇ ਵਿੱਚ ਆ ਕੇ ਉਸਨੂੰ ਵੇਖ ਕੇ ਨਿਹਾਲ ਹੁੰਦੇ ਹਨ ਅਤੇ ਮੈਂ ਵੀ ਬਹੁਤ ਉਹਨਾਂ ਇਹੋ ਜਿਹੇ ਦ੍ਰਿਸ਼ਾਂ ਦੇਖ ਕੇ ਕੁਦਰਤੀ ਬਹੁਤ ਖੁਸ਼ ਹੋਇਆ ਅਤੇ ਆਪਣੇ ਅੱਗੇ ਦੋਸਤਾਂ ਨੂੰ ਇਸ ਥਾਂ ਦੇ ਬਾਰੇ ਰਿਕਮੈਂਡ ਕਰਦਾ ਹਾਂ ਕਿ ਉਹ ਇੱਥੇ ਜਾਣ ਅਤੇ ਇਸ ਥਾਂ ਦੇ ਉੱਪਰੋਂ ਜੋ ਕੁਦਰਤ ਦੀਆਂ ਚੀਜ਼ਾਂ ਨੇ ਜਾਂ ਕੁਦਰਤ ਦੇ ਨਜ਼ਾਰੇ ਨੇ ਉਹਨਾਂ ਨੂੰ ਦੇਖਣ